ਪੰਜਾਬ ਵਿੱਚ ਵਪਾਰਕ ਚੁਣੌਤੀਆਂ ਆਉਂਦੀਆਂ ਰਹਿੰਦੀਆਂ ਹਨ ਪਰ ਇਨ੍ਹਾਂ ਚੁਣੌਤੀਆਂ ਨੂੰ ਨਜਿੱਠਣ ਲਈ ਸਰਕਾਰ ਦੁਆਰਾ ਰੁਲਜ਼ ਵੀ ਉਸ ਹਿਸਾਬ ਨਾਲ ਬ ਬਣਾਏ ਜਾਂਦੇ ਹਨ ਤਾਂ ਜੋ ਕਿਵੇਂ ਚੁਣੌਤੀਆਂ ਦਾ ਸਾਹਮਣਾ ਕਰ ਸਕੇ ਜਿਵੇਂ ਕਿ ਵਪਾਰ ਨੂੰ ਤਰਜੀਹ ਦੇਣ ਵਾਲੇ ਰੂਲਜ਼ ਬਣਾਏ ਜਾਂਦੇ ਹਨ ਤਾਂ ਜੋ ਕਿਸੇ ਨੂੰ ਵੀ ਵਪਾਰ ਕਰਨ ਵਿੱਚ ਕੋਈ ਦਿੱਕਤ ਨਾ ਆਏ ਅਤੇ ਉਹ ਅਸਾਨੀ ਨਾਲ ਆਪਣਾ ਵਪਾਰ ਸ਼ੁਰੂ ਕਰ ਸਕਣ ਵਪਾਰੀਆਂ ਦੇ ਲਈ ਟੈਕਸ ਕਟੌਤੀ ਕੀਤੀ ਜਾਂਦੀ ਹੈ ਤਾਂ ਕਿ ਉਹਨਾਂ ਦਾ ਧਿਆਨ ਆਪਣੇ ਵਪਾਰ ਵੱਲ ਲੱਗਿਆ ਰਹੇ ਅਤੇ ਉਸਨੂੰ ਉਹ ਹੋਰ ਵਿਕਸਿਤ ਕਰ ਸਕਣ ਸਰਕਾਰ ਵੱਲੋਂ ਟੈਂਡਰ ਵੀ ਜਾਰੀ ਕੀਤੇ ਜਾਂਦੇ ਹਨ ਤਾਂ ਜੋ ਵਪਾਰੀ ਵਰਗ ਉਸਦਾ ਫਾਇਦਾ ਲੈ ਸਕੇ ਅਤੇ ਆਪਣੇ ਆਪ ਨੂੰ ਹੋਰ ਵੱਧ ਵਧਾ ਸਕੇ